ਮੈਂ ਪਹਿਲਾਂ ਕੋਲਜ ਜਾਂਦੀ ਹੁੰਦੀ ਸੀਗੀ ਅਤੇ ਉਦੋਂ ਮਤਲਬ ਮੈਨੂੰ ਲੈਪਟੋਪ ਵਗੈਰਾ ਦੀ ਲੋੜ ਪੈਂਦੀ ਸੀ ਕਿਉਂਕਿ ਉੱਥੇ ਉਹਦੇ ਵਿੱਚ ਮੈਂ ਆਪਣੀਆਂ ਅਸਾਇਨਮੈਂਟ ਵਗੈਰਾ ਬਣਾ ਲੈਂਦੀ ਸੀ ਜਾਂ ਫਿਰ ਮਤਲਬ ਕੁਛ ਹੋਰ ਵਗੈਰਾ ਦੇਖ ਲੈਂਦੀ ਸੀਗੀ ਅਤੇ ਉਸ ਤੋਂ ਬਾਅਦ ਜਦੋਂ ਮਤਲਬ ਮੈਂ ਫ੍ਰੀ ਫ੍ਰੀ ਕੋਲਜ 'ਚ ਜਦੋਂ ਮਤਲਬ ਸਟੱਡੀ ਕੰਪਲੀਟ ਹੋ ਗਈ ਉਸ ਤੋਂ ਬਾਅਦ ਮੈਂ ਫ੍ਰੀ ਹੋ ਗਈ ਸੀਗੀ ਅਤੇ ਹੁਣ ਫਿਰ ਮੈਂ ਫੋਨ ਵਗੈਰਾ ਯੂਜ ਕਰਦੀ ਜਿਹਦੇ ਵਿੱਚ ਮੈਂ ਇੰਸਟਾ ਵਗੈਰਾ ਇੰਸਟਾ 'ਤੇ ਰੀਲ ਵਗੈਰਾ ਦੇਖ ਲੈਂਦੇ ਹਾਂ ਨਾ ਅਤੇ ਉਸ ਤੋਂ ਬਾਅਦ ਇੰਸਟਾ 'ਚ ਸਟੋਰੀ ਵਗੈਰਾ ਦੇਖ ਲੈਂਦੇ ਆ ਅਤੇ ਈ ਸਨੈਪਚੈਟ ਵਗੈਰਾ ਯੂਜ ਕਰਦੇ ਆ ਫੋਨ ਦੇ ਵਿੱਚ ਅਤੇ ਔਨਲਾਈਨ ਵਗੈਰਾ ਜੋਬ ਵਗੈਰਾ ਵੀ ਮਤਲਬ ਕਰ ਲੈਂਦੇ ਹਾਂ ਅਤੇ ਯੂ ਯੂਟਿਊਬ ਮੈਂ ਜਿਆਦਾ ਦੇਖਦੀ ਹਾਂ ਕਿਉਂਕਿ ਯੂਟਿਊਬ ਦੇ ਵਿੱਚ ਹੈ ਨਾ ਸਾਨੂੰ ਮੈਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਜਿਵੇਂ ਜਿਵੇਂ ਕੁਕਿੰਗ ਦੇ ਰਿਲੇਟਿਡ ਖਾਣਾ ਵਗੈਰਾ ਬਣਾਉਣ ਖਾਣਾ ਵਗੈਰਾ ਬਣਾਉਣ ਦੇ ਰਿਲੇਟਿਡ ਕਾਫੀ ਕੁਛ ਸਿੱਖਣ ਨੂੰ ਮਿਲਦਾ ਆ ਫਿਰ ਸੂਟ ਸਿ ਸੂਟ ਵਗੈਰਾ ਸਿੱਖਣਾ ਹੋਵੇ ਤਾਂ ਉਹ ਉਹ ਚ ਉਹ ਵੀਡੀਓਜ਼ ਵਗੈਰਾ ਵੀ ਆ ਜਾਂਦੀਆਂ ਅਤੇ ਮੈਂ ਉਸ ਯੂਟਿਊਬ ਤੋਂ ਕਾਫੀ ਕੁਝ ਸਿੱਖਿਆ ਹੈ ਜਿਵੇਂ ਸੂਟ ਵਗੈਰਾ ਕੱਟਣਾ ਜਾਂ ਸੀਣਾ ਹੈ ਨਾ ਅਤੇ ਉਸ ਤੋਂ ਬਾਅਦ ਮੈਂ ਕੁਕਿੰਗ ਵਗੈ ਕੁਕਿੰਗ ਦਾ ਵੀ ਬਹੁਤ ਸਿੱਖਿਆ ਹੈ ਜਿਵੇਂ ਕ ਕੋ ਅਲੱਗ ਅਲੱਗ ਚੀਜ਼ਾਂ ਬਣਾਉਣੀਆਂ ਮਤਲਬ ਜਿਵੇਂ ਬ੍ਰੈੱਡ ਰੋਲ ਹੋ ਗਏ ਹਰ ਇੱਕ ਚੀਜ਼ ਬਣਾਉਣੀ ਇ ਇੱਦਾਂ ਇਹ ਚੀਜ਼ ਸਿੱਖੀਆਂ ਅਤੇ ਸਨੈਪਚੈਟ ਵੀ ਚਲਾਉਣਾ ਮੈਨੂੰ ਬਹੁਤ ਵਧੀਆ ਲੱਗਦਾ ਕਿਉਂਕਿ ਸ ਸਨੈਪਚੈਟ ਦੇ ਵਿੱਚ ਹੈ ਨਾ ਮਤਲਬ ਫੋਟੋਸ ਵਗੈਰਾ ਵਧੀਆ ਆਉਂਦੀ ਆਉਂਦੀਆਂ ਅਤੇ ਕਾਫੀ ਵ ਕਾਫੀ ਵਧੀਆ ਮਤਲਬ ਫੋਨ 'ਚ ਸਾਰਾ ਟਾਈਮ ਮੈਂ ਫੋਨ ਹੀ ਚਲਾਉਂਦੀ ਰਹਿੰਦੀ ਹਾਂ